ਸਤਿ ਸ਼੍ਰੀ ਅਕਾਲ ਵੈਸੇ ਤਾਂ ਪੰਜਾਬ ਦੀ ਪੂਰੀ ਧਰਤੀ ਵੀਰਾਂ ਦੇ ਗਥਾਵਾਂ ਨਾਲ ਭਰੀ ਹੋਈ ਹਾਂ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ ਅੰਮ੍ਰਿਤਸਰ ਦੇ ਕਈ ਮਹੱਤਵਪੂਰਨ ਇਤਿਹਾਸਿਕ ਘਟਨਾਵਾਂ ਹੈਗੀਆਂ ਅੰਮ੍ਰਿਤਸਰ ਇੱਕ ਇਹ ਮਹੱਤਵਪੂਰਨ ਨਗਰੀ ਆ ਜਿੱਥੇ ਇਤਿਹਾਸਿਕ ਅਤੇ ਧਾਰਮਿਕ ਅਤੇ ਵਜ੍ਹਾ ਨਾਲ ਇਹ ਦੁਨੀਆਂ ਭਰ ਵਿੱਚ ਹਾਸਿਲ ਕਰਦਾ ਹੈ ਉਹਨਾਂ ਵਿੱਚ ਸਭ ਤੋਂ ਪਹਿਲੀ ਹੈਗੀ ਏ ਗੋਲਡਨ ਟੈਂਪਲ ਸ਼੍ਰੀ ਹਰਮਿੰਦਰ ਸਾਹਿਬ ਗੋਲਡਨ ਟੈਂਪਲ ਅੰਮ੍ਰਿਤਸਰ ਦੀ ਸਭਸੇ ਮਹੱਤਵਪੂਰਨ ਜਗ੍ਹਾ ਹੈ ਇਸ ਗੁਰਦੁਆਰੇ ਵਿੱਚ ਹਰ ਰੋਜ਼ ਲੱਖੋਂ ਲੋਕ ਅਰਦਾਸ ਕਰਨ ਆਉਂਦੇ ਆ ਅਤੇ ਲੰਗਰ ਵਿੱਚ ਸ਼ਾਮਿਲ ਹੋ ਕੇ ਸੇਵਾ ਕਰਦੇ ਆ ਕਿਹਾ ਜਾਂਦਾ ਹੈ ਕਿ ਹਰਮਿੰਦਰ ਸਾਹਿਬ ਵਿੱਚ ਅਸਲੀ ਸੋਨਾ ਚੜ੍ਹਾਇਆ ਸੀ ਇਹ ਸੋਨਾ ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਾਇਆ ਸੀ ਗੁਰਦੁਆਰੇ ਦਾ ਨਿਰਮਾਣ ਤਾਂ ਸਾਡੇ ਸਿੱਖਾਂ ਦੇ ਦੂਜੇ ਗੁਰੂ ਗੁਰੂ ਅਰਜਨ ਦੇਵ ਦੇ ਨਾਲ ਹੀ ਹੋ ਗਿਆ ਸੀ ਪਰ ਆਖਿਰ 'ਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨੂੰ ਸੋਨਾ ਚੜ੍ਹਾ ਕੇ ਬਹੁਤ ਸੁੰਦਰ ਗੁਰਦੁਆਰਾ ਬਣਾ ਤਾ ਸੀ ਦੂਜਾ ਜਲਿਆਂਵਾਲਾ ਬਾਗ ਸੰਨ ਉੱਨੀ ਸੌ ਉਣਾਸੀ 'ਚ ਜੋ ਹੋਈ ਸੀ ਸੰਨ ਉੱਨੀ ਸੌ ਉੱਨੀ ਮਾਫ ਕਰੀਏ ਸੰਨ ਉੱਨੀ ਸੌ ਉੱਨੀ ਵਿੱਚ ਜਲਿਆਂਵਾਲਾ ਬਾਗ 'ਚ ਇੱਕ ਪਾਰਕ ਸੀ ਜਿੱਥੇ ਕਈ ਸਾਰੇ ਲੋਕ ਵਿਸਾਖੀ ਮਿਨਾਲ ਲਈ ਸ਼ਾਮਿਲ ਹੋਏ ਸੀ ਇਕੱਠੇ ਹੋਏ ਸੀ ਅਤੇ ਜਰਨਲ ਡਾਇਰ ਨੇ ਬਿਨਾਂ ਕਿਸੇ ਵੋਰਨਿੰਗ 'ਤੇ ਸ਼ਾਂਤੀ ਮਾਰਚ ਵੇਲੇ ਲੋਕਾਂ 'ਤੇ ਫਾਇਰਿੰਗ ਕਰ ਦਿੱਤੀ ਜਿਸ ਵਕਤ ਹਜ਼ਾਰਾਂ ਲੋਕ ਮਰ ਗਏ ਸੀ ਅਤੇ ਤੀਜਾ ਸੰਨ ਉੱਨੀ ਸੌ ਚੁਰਾਸੀ ਵਿੱਚ ਔਪਰੇਸ਼ਨ ਬਲੂ ਸਟਾਰ ਜਿੰਨੇ ਵੀ ਲੋਕ ਗੋਲਡਨ ਟੈਂਪਲ ਗਏ ਹੋਏ ਸੀ ਕਿਰਤ ਕਰਨ ਅਤੇ ਪਾਠ ਕਰਨ ਅਤੇ ਦਰਸ਼ਨ ਕਰਨ ਉਹਨਾਂ ਲੋਕਾਂ 'ਤੇ ਫੌਜ ਚੜ੍ਹਾ ਦੀ ਗਈ ਸੀ ਕਿਉਂਕਿ ਉਸ ਟਾਈਮ 'ਤੇ ਇੱਕ ਆਤੰਕਵਾਦੀ ਸੰਤ ਜਰਨੈਲ ਸਿੰਘ ਉੱਥੇ ਛਿੱਪੇ ਹੋਏ ਸੀ ਤਾਂ ਆਰਮੀ ਉੱਥੇ ਚੜ੍ਹੀ ਹੋਈ ਸੀ ਅਤੇ ਉਹਨਾਂ ਲੋਕਾਂ ਨੂੰ ਮਾਰਨ ਲਈ ਕਰ ਕਿੰਨੇ ਸਾਰੇ ਕਾਨੂੰਨੀ ਅੰਦੋਲਨ ਕਰਦੀ ਪਈ ਸੀ ਤਾਂ ਜੋ ਵੀ ਲੋਕ ਉੱਥੇ ਫਸੇ ਹੋਏ ਸੀ ਉਹ ਸਭ ਮਰ ਗਏ ਸੀ ਇਸ ਵਿੱਚ ਚੌਥਾ ਵਾਗਾ ਬੋਡਰ ਇਹ ਬਹੁਤ ਹੀ ਸਾਡੇ ਲੀਏ ਅੰਮ੍ਰਿਤਸਰ ਵਿੱਚ ਇੰਡੀਆ ਅਤੇ ਪਾਕਿਸਤਾਨ ਦੀ ਸੀਮਾ ਦੇ ਬਾਗਾ ਬੋਡਰ ਹੈ ਜਿੱਥੇ ਹਰ ਦਿਨ ਸ਼ਾਮ ਨੂੰ ਭਾਰਤੀ ਅਤੇ ਪਾਕਿਸਤਾਨ ਦੀ ਜਵਾਨ ਫਲੈਗ ਲੋਵਰਿੰਗ ਸੈਬਰਿੰਗ ਸੈਰਮਨੀ ਕਰਦੇ ਆ ਇਹ ਕਿਸਮ ਦਿਨ ਦੀ ਧਮਾਲ ਨਾਲ ਭਰੀ ਹੁੰਦੀ ਆ ਨਾਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਵੀ ਇੱਥੇ ਨਜ਼ਦੀਕ ਦੀ ਜਗ੍ਹਾ ਸੁਲਤਾਨਪੁਰ ਲੋਧੀ ਵਿੱਚ ਹੋਇਆ ਸੀ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਧੰਨਵਾਦ ਜੀ